ਧਾਰਮਿਕ ਤਿਉਹਾਰਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਾਡੇ ਜਾਂ ਮੈਂ ਕਹਾਂ ਮੇਰੇ ਆਪਣੇ ਸਿੱਖ ਪੰਥ ਦੇ ਵਿੱਚ ਮੂਰਤੀ ਪੂਜਾ ਦਾ ਤਾਂ ਖੰਡਨ ਕੀਤਾ ਜਾਂਦਾ ਤਾਂ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਇਸ ਬਾਰੇ 'ਚ ਕੋਈ ਦਿਲਚਸਪੀ ਹੈ ਨਹੀਂ ਹੈ ਅਤੇ ਨਾ ਹੀ ਕਦੇ ਅਸੀਂ ਇਹ ਕੰਮ ਕੀਤਾ ਹੈ ਨਾ ਹੀ ਅਸੀਂ ਕਦੀ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਕਦੀ ਜ਼ਰੂਰਤ ਹੀ ਨਹੀਂ ਪਈ ਅਤੇ ਇਸ ਕਰਕੇ ਕੋਈ ਖਾਸ ਨੋਲੇਜ ਵੀ ਹੈ ਨਹੀਂ ਸਾਨੂੰ ਇਸ ਬਾਰੇ ਦੇ ਵਿੱਚ